ਡਰਾਈਵਰ ਸਰ ਕੀ ਤੁਹਾਡੇ ਕੋਲ ਯੂ ਪੀ ਆਈ ਹੈਗਾ ਮੈਂ ਘਰੋਂ ਚੱਲੀ ਸੀ ਘੁੰਮਣ ਵਾਸਤੇ ਦਰਬਾਰ ਸਾਹਿਬ ਜਲ੍ਹਿਆਂਵਾਲੇ ਬਾਗ ਅਤੇ ਸ਼ਹੀਦੀ ਸਾਹਿਬ ਮੈਂ ਘੁੰਮ ਚੁੱਕੀ ਹਾਂ ਮੇਰਾ ਘਰ ਹੁਣ ਪੰਜ ਮਿੰਟ ਦੀ ਦੂਰੀ 'ਤੇ ਹੈ ਮੈਂ ਆਪਣੀ ਜੇਬ ਵਿੱਚ ਦੇਖਿਆ ਤਾਂ ਮੇਰਾ ਪਰਸ ਚੋਰੀ ਹੋ ਚੁੱਕਾ ਹੈ ਮੈਂ ਤੁਹਾਡਾ ਭੁਗਤਾਨ ਹਜੇ ਕਰਨਾ ਹੈ ਹੁਣ ਤੁਸੀਂ ਮੈਨੂੰ ਦੱਸੋ ਕਿ ਤੁਹਾਡੇ ਕੋਲ ਯੂ ਪੀ ਆਈ ਹੈਗਾ ਜੇ ਨਹੀਂ ਤਾਂ ਮੈਂ ਤੁਹਾਡਾ ਪੇਅ ਗੂਗਲ ਪੇਅ ਪੇਅਟੀਐੱਮ ਜਾਂ ਔਨਲਾਈਨ ਭੁਗਤਾਨ ਕਰ ਸਕਦੀ ਹਾਂ ਯੂ ਪੀ ਆਈ ਹੈ ਤਾਂ ਮੈਂ ਜੂ ਪੀ ਆਈ ਰਾਹੀਂ ਹੀ ਭੁਗਤਾਨ ਕਰ ਸਕਦੀ ਹਾਂ